ਸਤਿ ਸ੍ਰੀ ਅਕਾਲ ਸਰ ਅਸੀਂ ਜਾਣਦੇ ਹਾਂ ਕਿ ਪਸ਼ੂ ਪਾਲਣ ਨਾਲ ਸਾਡੇ ਬਹੁਤ ਜ਼ਿਆਦਾ ਕਾਰੋਬਾਰ ਖੁਲ ਸਕਦੇ ਹਨ ਇਸ ਕਰਕੇ ਸਾਨੂੰ ਪਸ਼ੂਆਂ ਪਾਲਣ ਤੋਂ ਕਈ ਕਈ ਰੁਜ਼ਗਾਰ ਮਿਲ ਸਕਦੇ ਹੈ ਦੁੱਧ ਦਹੀਂ ਡੇਰੀ ਤੋਂ ਪਨੀਰ ਵੀ ਪੈਦਾ ਕਰ ਸਕਦੇ ਹਾਂ ਪਸ਼ੂ ਪਾਲਣ ਨਾਲ ਸਾਨੂੰ ਬਹੁਤ ਜ਼ਿਆਦਾ ਲਾਭਦਾਇਕ ਵਪਾਰ ਪ੍ਰਾਪਤ ਹੁੰਦਾ ਹੈ ਪਰ ਇਹਨਾਂ ਦੇ ਨਾਲ ਪਸ਼ੂ ਪਾਲ ਪਸ਼ੂ ਪਾਲਣ ਨਾਲ ਘਰਾਂ ਦੇ ਆਂਡ ਗੁਆਂਡ ਨੂੰ ਅਸੀਂ ਦੁੱਧ ਵੀ ਵੇਚ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹੈ ਇਸ ਕਰਕੇ ਪਸ਼ੂ ਪਾਲਣ ਨਾਲ ਸਾਨੂੰ ਬਹੁਤ ਜ਼ਿਆਦਾ ਹਾਨੀ ਲਾਭਦਾਇਕ ਹੈ